ਗਿਆਰ੍ਹਾਂ ਜੁਲਾਈ ਉੱਨੀ ਸੌ ਸਤਵੰਜਾ ਇੱਕ ਅਕਤੂਬਰ ਉੱਨੀ ਸੌ ਇਕਾਹਠ ਤਿੰਨ ਮਾਰਚ ਉੱਨੀ ਸੌ ਚੁਰਾਸੀ ਅੱਠ ਅਕਤੂਬਰ ਉੱਨੀ ਸੌ ਛਿਆਨਵੇਂ ਇਕੱਤੀ ਅਕਤੂਬਰ ਉੱਨੀ ਸੌ ਪਚਾਸੀ